ਮੈਨੂੰ ਫੋਟੋਗ੍ਰਾਫੀ ਕਰਨ ਦਾ ਬਹੁਤ ਸ਼ੌਕ ਹੈ ਮੈਂ ਅਕਸਰ ਹੀ ਆਪਣੀ ਫੋਟੋਗ੍ਰਾਫੀ ਵਿੱਚ ਕੁਦਰਤ ਦੇ ਨਜ਼ਾਰਿਆਂ ਨੂੰ ਕੈਦ ਕਰਦਾ ਹਾਂ ਮੈਂ ਫੋਟੋਗ੍ਰਾਫੀ ਦਾ ਜਦੋਂ ਕਰਦਾ ਹਾਂ ਤਾਂ ਲਗਭਗ ਅੰਮ੍ਰਿਤ ਵੇਲੇ ਫੋਟੋਗ੍ਰਾਫੀ ਸੂਰਜ ਦਾ ਚੜ੍ਹਨਾ ਸੂਰਜ ਦਾ ਛਿਪਣਾ ਉਸ ਨੂੰ ਕੈਪਚਰ ਕਰਦਾ ਹਾਂ ਇਸ ਤੋਂ ਇਲਾਵਾ ਮੈਂ ਉੱਡਦੇ ਹੋਏ ਪੰਛੀਆਂ ਨੂੰ ਆਪਣੀ ਫੋਟੋਗ੍ਰਾਫੀ ਵਿੱਚ ਕੈਦ ਕਰਕੇ ਸਕੂਨ ਮਹਿਸੂਸ ਕਰਦਾ ਹਾਂ ਇਸ ਤਰ੍ਹਾਂ ਹੀ ਪਹਾੜਾਂ ਵਿੱਚ ਸਨਸੈਂਟ ਪੁਆਇੰਟ ਜਿੱਥੇ ਸੂਰਜ ਛਿਪਦਾ ਹੈ ਸੂਰਜ ਜਿੱਥੋਂ ਉੱਗਦਾ ਹੈ ਉਸ ਸਮੇਂ ਨੂੰ ਕੈਪਚਰ ਕਰਨਾ ਮੈਨੂੰ ਬਹੁਤ ਵਧੀਆ ਲੱਗਦਾ ਹੈ ਨਾਲ ਦੀ ਨਾਲ ਪਾਣੀ ਦਾ ਜੋ ਲਗਾਤਾਰ ਵਹਿੰਦਾ ਹੈ ਵਹਿੰਦੇ ਹੋਏ ਪਾਣੀ ਨੂੰ ਵੀ ਮੈਂ ਆਪਣੀ ਫੋਟੋਗ੍ਰਾਫੀ ਵਿੱਚ ਪ੍ਰਤੀਕਾਤਮਕ ਰੂਪ ਵਿੱਚ ਕੈਦ ਕਰਦਾ ਹਾਂ ਜਿਸ ਦਾ ਇੱਕ ਸੁਨੇਹਾ ਜਾਂਦਾ ਹੈ ਜ਼ਿੰਦਗੀ ਇੱਕ ਵਹਿੰਦਾ ਦਰਿਆ ਹੈ ਸ਼ੁਕਰੀਆ